ਮੈਂ ਖਬਰਾਂ ਨੂੰ ਦੋ ਜਾਂ ਤਿੰਨ ਵਾਰ ਪੜ੍ਹਦੀ ਔਰ ਸੁਣਦੀ ਹਾਂ ਮੈਂ ਅਪਰਾਧ ਅਤੇ ਸਿੱਖਿਆ ਕੇਂਦਰ ਦੀਆਂ ਖਬਰਾਂ ਦੇਖਣਾ ਪਸੰਦ ਕਰਦੀ ਹਾਂ ਅਪਰਾਧ ਦੀਆਂ ਇਸ ਲਈ ਤਾਂ ਕਿ ਸਾਨੂੰ ਪਤਾ ਚੱਲੇ ਕਿ ਸਾਡੇ ਸਮਾਜ ਵਿੱਚ ਕਿਸ ਤਰ੍ਹਾਂ ਦੇ ਅਪਰਾਧ ਹੋ ਰਹੇ ਹਨ ਤਾਂ ਅਸੀਂ ਉਹਨਾਂ ਨੂੰ ਦੇਖ ਕੇ ਆਪ ਬਚ ਸਕੀਏ ਸਿੱਖਿਆ ਦੇ ਇਸ ਲਈ ਤਾਂ ਕਿ ਸਿੱਖਿਆ ਕੇਂਦਰ ਦਾ ਪਤਾ ਚੱਲਦਾ ਰਹਿੰਦਾ ਹੈ ਕੀ ਕੀ ਨੌਕਰੀਆਂ ਨਿਕਲੀਆਂ ਹਨ ਕੀ ਅੱਗੇ ਹੈ ਆਪਾਂ ਕੀ ਬੱਚਿਆ ਵਿੱਚ ਸਿੱਖਿਆ ਦਾ ਸੁਧਾਰ ਕਰ ਸਕਦੇ ਹਾਂ ਅਪਰਾਧ ਕਿਉਂਕਿ ਕੁੜੀਆਂ ਦੇ ਬਹੁਤ ਅਪਰਾਧ ਹੋ ਗਏ ਹਨ ਦਹੇਜ ਪ੍ਰਥਾ ਅਪਰਾਧ ਬਲਾਤਕਾਰ ਦੇ ਅਪਰਾਧ ਤਾਂ ਕਿ ਅਸੀਂ ਉਹਨਾਂ ਨੂੰ ਦੇਖ ਕੇ ਸਿੱਖ ਸਕੀਏ ਕਿ ਆਪਣੀਆਂ ਕੁੜੀਆਂ ਨੂੰ ਕਿਸ ਤਰ੍ਹਾਂ ਸੇਫ ਕਰ ਸਕਦੇ ਹਾਂ ਕੀ ਸਿਖਾ ਸਕਦੇ ਹਾਂ ਉਹਨਾਂ ਨੂੰ ਕਿ ਇਹਨਾਂ ਤੋਂ ਬਚਣਾ ਚਾਹੀਦਾ ਹੈ